ਪਹਿਲੇ ਦੇ ਸਮੇਂ ਨਾਲ ਅੱਜ ਦੇ ਸਮੇਂ ਵਿੱਚ ਲੋਕਾਂ ਦੇ ਪਹਿਰਾਵੇ ਵਿੱਚ ਬਹੁਤ ਫਰਕ ਪੈ ਗਿਆ ਹੈ ਪਹਿਲੇ ਦੇ ਸਮੇਂ ਵਿੱਚ ਕੁੜੀਆਂ ਸਲਵਾਰ ਕਮੀਜ਼ ਅਤੇ ਮੁੰਡੇ ਨਵ ਗੱਬਰੂ ਕੁੜਤਾ ਪਜਾਮਾ ਪਹਿਨਦੇ ਸਨ ਪਰ ਅੱਜ ਦੇ ਮੁਕਾਬਲੇ ਵੈਸਟਰਨ ਕਲਚਰ ਨੇ ਜ਼ਿਆਦਾ ਪ੍ਰਭਾਵ ਪਾ ਦਿੱਤਾ ਹੈ ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਜ਼ਿਆਦਾਤਰ ਜੀਨ ਟੋਪ ਪਾਉਂਦੇ ਹਨ ਅਤੇ ਮੁੰਡੇ ਜ਼ਿਆਦਾਤਰ ਸ਼ਰਟ ਪੈਂਟ ਹੀ ਪਾਉਂਦੇ ਹਨ ਪਰ ਜਿੱਥੇ ਤੱਕ ਮੈਂ ਆਪਣੀ ਗੱਲ ਕਰਾਂ ਮੈਨੂੰ ਅੱਜ ਦੇ ਸਮੇਂ ਵਿੱਚ ਵੀ ਪੰਜਾਬ ਵਿੱਚ ਰਹਿ ਕੇ ਵੀ ਮੈਂ ਇੱਕ ਪਟਿਆਲਾ ਵਿੱਚ ਰਹਿੰਦੀ ਹਾਂ ਅਤੇ ਮੈਨੂੰ ਪੰਜਾਬ ਵਿੱਚ ਰਹਿ ਕੇ ਕੁੜਤਾ ਪਜਾਮਾ ਅਤੇ ਸੂਟ ਸਲਵਾਰ ਪਹਿਨਣ ਵਾਲੇ ਲੋਕ ਬਹੁਤ ਪਸੰਦ ਹਨ ਮੈਂ ਵੀ ਸੂਟ ਸਲਵਾਰ ਪਹਿਨਦੀ ਹਾਂ ਮੈਂ ਕੋਲੇਜ ਜਾਂਦੀ ਹਾਂ ਜਦ ਮੈਂ ਓਦੋਂ ਵੀ ਕੁੜਤੇ ਪਜਾਮਾ ਵਾਲੇ ਮੁੰਡੇ ਅਤੇ ਸਲਵਾਰ ਸੂਟ ਵਾਲੇ ਕਮੀਜ਼ਾਂ ਵਿੱਚ ਦੇਖਦੀ ਹਾਂ ਮੈਨੂੰ ਉਹ ਮੁੰਡੇ ਕੁੜੀਆਂ ਬਹੁਤ ਹੀ ਪ੍ਰਭਾਵਿਤ ਲੱਗਦੇ ਹਨ ਮੈਂ ਆਪਣੇ ਕੱਪੜੇ ਆਪਣੇ ਸ਼ਹਿਰ ਦੇ ਨੇੜਲੀਆਂ ਦੁਕਾਨਾਂ ਤੋਂ ਹੀ ਖਰੀਦ ਦੀ ਹਾਂ ਜਿਸ ਵਿੱਚ ਉਹ ਕੱਪੜੇ ਮੈਨੂੰ ਠੀਕ ਢੰਗ ਦੇ ਰੇਟ ਵਿੱਚ ਮਿਲ ਜਾਂਦੇ ਹਨ ਅਤੇ ਉਹ ਬਹੁਤ ਅੱਛੇ ਸਟੱਫ ਵਿੱਚ ਵੀ ਮਿਲ ਜਾਂਦੇ ਹਨ